ਛੋਟੇ ਹੁੰਦੇ ਹੋਏ ਥੋੜ੍ਹਾ ਬਹੁਤਾ ਉੱਚਾਈ ਤੋਂ ਡਰ ਲੱਗਦਾ ਸੀ ਕਈ ਵਾਰੀ ਬੱਸ 'ਤੇ ਜਾਣਾ ਤਾਂ ਜਾਂ ਪੁਲ 'ਤੇ ਚੜ੍ਹਨਾ ਬੱਸ ਮੰਮੀ ਨਾਲ ਕਿਤੇ ਨਾਨਕੇ ਜਾਣਾ ਜਾਂ ਦਾਦਕੇ ਜਾਣਾ ਤਾਂ ਰਸਤੇ 'ਚ ਕਈ ਵਾਰੀ ਪੁਲ ਚੜ੍ਹਦਾ ਤਾਂ ਐਂ ਲੱਗਦਾ ਯਾਰ ਕਿਤੇ ਥੱਲੇ ਨਾ ਡਿੱਗ ਪਈਏ ਹਾਏ ਐਡੀ ਉੱਚੀ ਵਗ ਗਏ ਤਾਂ ਹੌਲੀ ਹੌਲੀ ਜਿਵੇਂ ਵੱਡੇ ਹੋਏ ਹੌਲੀ ਹੌਲੀ ਪਾਰਕਾਂ ਦੇ ਵਿੱਚ ਜਾਣਾ ਜਾਂ ਉੱਤੇ ਚੜ੍ਹ ਜਾਣਾ ਦਰਖਤਾਂ ਦੇ ਉੱਤੇ ਅਤੇ ਵੱਡੇ ਹੁੰਦੇ ਸ਼ਰਾਰਤਾਂ ਕਰਦੇ ਕਰਦੇ ਅਤੇ ਇੱਕ ਵਾਰੀ ਅਸੀਂ ਟੂਰ 'ਤੇ ਗਏ ਹਿਮਾਚਲ ਪਹਾੜੀਆਂ ਸੀ ਵੱਡੀਆਂ ਮੈਨੂੰ ਐਂ ਲੱਗਾ ਪਹਾੜੀਆਂ ਉੱਤੇ ਨਾ ਡਿੱਗ ਪੈਣ ਮੇਰੇ ਬਟ ਜਿਵੇਂ ਜਿਵੇਂ ਬੱਸ ਉੱਤੋਂ ਜਾਂਦੀ ਐਂ ਲੱਗਦਾ ਵੀ ਪਹਾੜ ਉੱਤੇ ਨਾ ਡਿੱਗ ਪਏ ਸਾਡੇ ਇਸ ਤਰੀਕੇ ਨਾਲ ਹੌਲੀ ਹੌਲੀ ਅਸੀਂ ਮੇਰੇ ਦ ਪਤਾ ਲੱਗਿਆ ਦੋਸਤਾਂ ਨੂੰ ਵੀ ਇਹ ਡਰਦਾ ਪਹਾੜ ਤੋਂ ਅਸੀਂ ਹੌਲੀ ਹੌਲੀ ਚੜ੍ਹਨ ਲੱਗ ਗਏ ਇੱਦਾਂ ਹੀ ਮੇਰਾ ਡਰ ਖੁੱਲ੍ਹ ਗਿਆ ਪਹਾੜੀਆਂ ਤੋਂ ਇੱਦਾਂ ਇੱਕ ਵਾਰੀ ਉੱਤਰਾਖੰਡ ਗਏ ਅਸੀਂ ਉੱਤਰਾਖੰਡ ਰਾਫਟਿੰਗ ਵੀ ਕੀਤੀ ਉੱਤਰਾਖੰਡ ਦੀਆਂ ਪਹਾੜੀਆਂ 'ਤੇ ਵੀ ਜਾ ਕੇ ਆਏ ਤਾਂ ਹੌਲੀ ਹੌਲੀ ਹੁਣ ਡਰ ਖੁੱਲ੍ਹ ਗਿਆ ਹੁਣ ਕੋਈ ਡਰ ਨਹੀਂ ਹੈਗਾ ਹੁਣ ਪਹਾੜੀਆਂ 'ਤੇ ਜਾ ਸਕਦੇ ਹਾਂ ਮਚਿਓਰ ਹੋ ਗਏ ਹਾਂ ਹੁਣ ਤਾਂ ਬੱਚਿਆਂ ਨੂੰ ਵੀ ਦੱਸਦੇ ਹਾਂ ਦੱਸਦੇ ਹਾਂ ਵੀ ਪਹਾੜਾਂ ਤੋਂ ਡਰਨਾ ਨਹੀਂ ਕਦੇ ਵੀ ਉੱਚਾਈ ਤੋਂ ਬੇਟਾ ਜ਼ਿੰਦਗੀ ਨੂੰ ਹਮੇਸ਼ਾ ਉੱਚਾਈ ਤੱਕ ਲੈ ਕੇ ਜਾਣਾ ਉੱਚਾਈਆਂ 'ਤੇ ਪਹੁੰਚਣਾ ਜ਼ਿੰਦਗੀ ਦਾ ਮੁਕਾਮ ਹੈ ਅਤੇ ਉੱਚਾਈ ਤੋਂ ਕਦੇ ਡਰਨਾ ਨਹੀਂ ਇਸ ਕਰਕੇ ਪਹਿਲਾਂ ਬਚਪਨ 'ਚ ਡਰਦੇ ਸੀ ਹੁਣ ਆਪਾਂ ਨੂੰ ਕੋਈ ਵੀ ਡਰ ਨਹੀਂ ਲੱਗਦਾ ਹੁਣ ਆਪਾਂ ਅੱਗੇ ਵੱਧ ਰਹੇ ਹਾਂ